ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ ਸੱਭਿਆਚਾਰ ਹੈ ਪੰਜਾਬੀ ਜਿੱਥੇ ਆਪਣੇ ਦੁੱਖ ਨੂੰ ਵੀ ਰਲ ਕੇ ਮਨਾਉਣਾ ਜਾਣਦੇ ਹਨ ਉੱਥੇ ਆਪਣੀ ਖੁਸ਼ੀ ਨੂੰ ਵੀ ਇਹ ਰਲ ਕੇ ਹੀ ਮਨਾਉਂਦੇ ਹਨ ਖੁਸ਼ੀ ਮਨਾਉਣ ਵੇਲੇ ਇਹ ਬਹੁਤ ਹੀ ਜੋਸ਼ ਵਿੱਚ ਆ ਜਾਂਦੇ ਹਨ ਅਤੇ ਇਹ ਖੁਸ਼ੀ ਇਹਨਾਂ ਦੀ ਦਰਸ਼ਾਉਣ ਲਈ ਇਹਨਾਂ ਕੋਲ ਸਭ ਤੋਂ ਵਧੀਆ ਜੋ ਡਾਂਸ ਹੈ ਉਸ ਨੂੰ ਭੰਗੜਾ ਕਿਹਾ ਜਾਂਦਾ ਹੈ ਭੰਗੜੇ ਨੂੰ ਹਰ ਖੁਸ਼ੀ ਵੇਲੇ ਪਾਇਆ ਜਾਂਦਾ ਹੈ ਭੰਗੜਾ ਪਾਉਣ ਵੇਲੇ ਤੁਰਲੇ ਵਾਲੀ ਪੱਗ ਬੰਨੀ ਜਾਂਦੀ ਹੈ ਨਵਾਂ ਕੁੜਤਾ ਪਾਇਆ ਜਾਂਦਾ ਹੈ ਚਾਦਰਾ ਬੰਨਿਆ ਜਾਂਦਾ ਹੈ ਅਤੇ ਪੂਰੇ ਸਰੀਰ ਨੂੰ ਖੋਲ ਕੇ ਪੂਰੇ ਜੋਸ਼ ਨਾਲ ਭੰਗੜਾ ਪਾਇਆ ਜਾਂਦਾ ਹੈ ਖੁਸ਼ੀ ਨੂੰ ਦਰਸ਼ਾਉਣ ਲਈ ਭੰਗੜੇ ਤੋਂ ਜ਼ਿਆਦਾ ਵਧੀਆ ਕੋਈ ਪੂਰੀ ਦੁਨੀਆਂ ਵਿੱਚ ਨਾਚ ਨਹੀਂ ਹੈ ਭੰਗੜੇ ਨੂੰ ਇਹ ਹਰ ਖੁਸ਼ੀ ਵੇਲੇ ਪਾਇਆ ਜਾਂਦਾ ਹੈ ਇਸ ਨੂੰ ਵਿਆਹ ਸ਼ਾਦੀਆਂ ਵਿਚ ਬਹੁਤ ਜੀ ਜੋਸ਼ ਨਾਲ ਪੂਰੇ ਬਾਰਾਤੀ ਪਾਉਂਦੇ ਹਨ ਅੱਜ ਕੱਲ੍ਹ ਤਾਂ ਲੜਕੀ ਵਾਲੇ ਵੀ ਭੰਗੜਾ ਪਾਉਂਦੇ ਹਨ ਇਸ ਤੋਂ ਇਲਾਵਾ ਭੰਗੜਾ ਫੰਕਸ਼ਨਾਂ ਦੀ ਵੀ ਸ਼ਾਨ ਹੈ ਕਾਲਜਾਂ ਯੂਨੀਵਰਸਿਟੀਆਂ ਵਿੱਚ ਵਧੀਆ ਭੰਗੜਾ ਪਾਉਣ ਲਈ ਸਟੂਡੈਂਟਸ ਦੇ ਕੰਪੀਟੀਸ਼ਨ ਵੀ ਹੁੰਦੇ ਹਨ ਜਿਸ ਵਿੱਚ ਵਧੀਆ ਤੋਂ ਵਧੀਆ ਭੰਗੜਾ ਪ੍ਰਫੋਰਮ ਕਰਨ ਵਾਲਾ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਵੀ ਭੰਗੜਾ ਪਾਉਂਦਾ ਹੈ ਮੇਲਿਆਂ ਤਿਉਹਾਰਾਂ ਵਿੱਚ ਵੀ ਭੰਗੜੇ ਤੋਂ ਬਿਨਾਂ ਸ਼ਾਨ ਅਧੂਰੀ ਹੈ ਅਤੇ ਪੰਜਾਬੀਆਂ ਦੇ ਵਿਸਾਖੀ ਦਾ ਤਿਉਹਾਰ ਵੀ ਭੰਗੜੇ ਤੋਂ ਬਿਨਾਂ ਤਾਂ ਬਿਲਕੁਲ ਹੀ ਅਧੂਰਾ ਹੈ ਵਿਸਾਖੀ ਵੇਲੇ ਕਣਕਾਂ ਵੱਢ ਕੇ ਵੇਚ ਦਿਤੀਆਂ ਜਾਂਦੀਆਂ ਹਨ ਅਤੇ ਇਸ ਵ ਇਸ ਖੁਸ਼ੀ ਨੂੰ ਦਰਸ਼ਾਉਣ ਲਈ ਸਾਰੇ ਜ਼ਮੀਦਾਰ ਲੋਕ ਅਤੇ ਆਮ ਲੋਕ ਨਵੇਂ ਦਾਣੇ ਘਰ ਵਿਚ ਆਉਣ ਦੀ ਖੁਸ਼ੀ ਵਿਚ ਭੰਗੜਾ ਪਾ ਕੇ ਵਿਸਾਖੀ ਦੇ ਮੇਲੇ ਵਿਚ ਖੁਸ਼ੀ ਨੂੰ ਸਾਂਝਾ ਕਰਦੇ ਹਨ ਲੋਹੜੀ ਦਾ ਤਿਉਹਾਰ ਵੀ ਭੰਗੜੇ ਬਿਨਾਂ ਅਧੂਰਾ ਹੈ ਜਦੋਂ ਵਿਚਾਲੇ ਅੱਗ ਬਾਲ ਕੇ ਚਾਰੇ ਪਾਸੇ ਖੁਸ਼ੀ ਵੇਲੇ ਮਾਹੌਲ ਵੇਲੇ ਪਰਿਵਾਰ ਵਾਲੇ ਅਤੇ ਆਂਢੀ ਗੁਆਂਢੀ ਭੰਗੜਾ ਪਾ ਕੇ ਆਪਣੀ ਖੁਸ਼ੀ ਦਰਸ਼ਾਉਂਦੇ ਹਨ ਭੰਗੜਾ ਪੰਜਾਬੀਆਂ ਦੀ ਸ਼ਾਨ ਹੈ ਜਿਸ ਨੇ ਕਿ ਪੰਜਾਬੀਆਂ ਨੂੰ ਸਾਰੀ ਦੁਨੀਆਂ ਵਿੱਚ ਮਸ਼ਹੂਰ ਕੀਤਾ ਹੈ ਭੰਗੜਾ ਪੰਜਾਬੀ ਸੱਭਿਆਚਾਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਜੋ ਕਿ ਪੰਜਾਬੀਆਂ ਦੀ ਅਪਣੱਤ ਨੂੰ ਵੀ ਦਰਸ਼ਾਉਂਦਾ ਹੈ ਕਿਉਂਕਿ ਇਹ ਰਲ ਕੇ ਪਾਇਆ ਜਾਂਦਾ ਹੈ ਇਸ ਵਿੱਚ ਗੂੜੇ ਰੰਗ ਦੇ ਕੱਪੜੇ ਪਾਏ ਜਾਂਦੇ ਹਨ ਜੋ ਕਿ ਦੇਖਣ ਵਾਲੇ ਨੂੰ ਵੀ ਬਹੁਤ ਹੀ ਸੋਹਣੇ ਲੱਗਦੇ ਹਨ ਭੰਗੜਾ ਪਾਉਣ ਵਾਲਾ ਪੂਰੇ ਜੋਸ਼ ਨਾਲ ਭੰਗੜਾ ਪਾਉਂਦਾ ਹੈ ਜਿਸ ਨਾਲ ਉਸ ਦੇ ਹੱਥ ਪੈਰ ਪੂਰੇ ਖੁੱਲਦੇ ਹਨ ਅਤੇ ਜਿਸ ਨਾਲ ਉਹ ਆਪਣੀ ਖੁਸ਼ੀ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਪ੍ਰਗਟ ਕਰ ਸਕਦਾ ਹੈ ਭੰਗੜਾ ਪੰਜਾਬੀ ਸੱਭਿਆਚਾਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਕਿਉਂਕਿ ਸਾਰੇ ਪੰਜਾਬੀਆਂ ਦੇ ਤਿਉਹਾਰ ਪੰਜਾਬੀਆਂ ਦੇ ਮੇਲੇ ਪੰਜਾਬੀਆਂ ਦੇ ਵਿਆਹ ਅਤੇ ਪੰਜਾਬੀਆਂ ਦੀ ਹਰ ਖੁਸ਼ੀ ਦੀ ਘੜੀ ਭੰਗੜੇ ਬਿਨਾਂ ਅਧੂਰੀ ਹੈ